ਨੇਵੀਗੇਸ਼ਨ ਐਪ ਜਿਵੇਂ ਕਿ ਗੂਗਲ ਅਰਥ ਗੂਗਲ ਮੈਪ ਜਿਸ ਦੀ ਵਰਤੋਂ ਮੈਂ ਆਮ ਦਿਨਾਂ ਵਿੱਚ ਕਰਦਾ ਹਾਂ ਇਹ ਮੈਪ ਦੀ ਵਰਤੋਂ ਕਾਰਨ ਜਦੋਂ ਵੀ ਮੈਂ ਕਿਸੇ ਵੀ ਥਾਂ ਕਿਸੇ ਵੀ ਸ਼ਹਿਰ ਪਿੰਡ ਜਿੱਥੇ ਜਾਣਾ ਹੋਏ ਉਸ ਥਾਂ ਆਸਾਨੀ ਨਾਲ ਜਾ ਸਕਦਾ ਹਾਂ ਮੈਪ 'ਤੇ ਕੁਝ ਵੀ ਸਰਚ ਕਰਨ 'ਤੇ ਉਸ ਦੀ ਸਹੀ ਦਿਸ਼ਾ ਵਿਖ ਜਾਂਦੀ ਹੈ ਸਹੀ ਰਸਤਾ ਪਤਾ ਲੱਗ ਜਾਂਦਾ ਹੈ ਇਸ ਮੈਪ ਦੇ ਟੈਕਨੋਲੋਜੀ ਕਾਰਨ ਸਾਨੂੰ ਕਿਸੇ ਨੂੰ ਵੀ ਕੁਝ ਵੀ ਪੁੱਛਣ ਦੀ ਜ਼ਰੂਰਤ ਨਹੀਂ ਹੈ ਇਸ ਨਾਲ ਨੈਵੀਗੇਸ਼ਨ ਕਾਫੀ ਆਸਾਨ ਹੋ ਗਿਆ ਹੈ ਕੋਈ ਵੀ ਥਾਂ ਲੱਭਣੀ ਹੋਵੇ ਕੋਈ ਵੀ ਦੁਕਾਨ ਲੱਭਣੀ ਹੋਵੇ ਜਾਂ ਕੋਈ ਵੀ ਹੋਵੇ ਨੈਵੀਗੇਸ਼ਨ ਐਪ ਗੂਗਲ ਮੈਪਸ ਦੇ ਦੁਆਰਾ ਅਸੀਂ ਇਸ ਨੂੰ ਆਸਾਨੀ ਨਾਲ ਲੱਭ ਸਕਦੇ ਹਾਂ